ਗੇਮਾਂ ਖੇਡਣੀਆਂ ਬਹੁਤ ਹੀ ਸਿਹਤ ਲਈ ਚੰਗੀਆਂ ਹਨ ਗੇਮ ਖੇਡਣ ਨਾਲ ਸਾਡੇ ਸਰੀਰ ਦੇ ਸਾਰੇ ਅੰਗ ਨੂੰ ਹਿਲਜੁਲ ਹੁੰਦੀ ਹੈ ਅਤੇ ਤੰਦਰੁਸਤ ਵੀ ਰਹਿੰਦੇ ਹਾਂ ਅਸੀਂ ਕਿ ਬਚਪਨ ਤੋਂ ਅਸੀਂ ਬਹੁਤ ਹੀ ਗੇਮਾਂ ਖੇਡਦੇ ਸੀ ਜਿੱਦਾਂ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਸਾਰੇ ਬੱਚੇ ਆਪਸ ਦੇ ਵਿੱਚ ਗੇਮਾਂ ਖੇਡਦੇ ਸੀਗੇ ਹੁਣ ਜਿੱਦਾਂ ਜੀਤੋ ਜਿਹਦੇ ਤੋਂ ਸਮਾਂ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉੱਦਾਂ ਹੀ ਗੇਮ ਦੇ ਜਿਹੜਾ ਖੇਡਣ ਦਾ ਧਿਆਨ ਸੀ ਬੱਚਿਆਂ ਦਾ ਉਹ ਵੀ ਬਦਲ ਗਿਆ ਹੁਣ ਬੱਚੇ ਗੇਮ ਨਹੀਂ ਖੇਡਦੇ ਉਹ ਫ਼ੋਨ 'ਤੇ ਗੇਮ ਖੇਡਦੇ ਆ ਮੋਬਾਈਲ 'ਤੇ ਉਹ ਹਰ ਪਲ ਮੋਬਾਈਲ 'ਤੇ ਗੇਮ ਨੂੰ ਖੇਡਣ 'ਚ ਇੰਟਰਸਟ ਲੈਂਦੇ ਹੈ ਇਸ ਇੱਕ ਦਮ ਜਿੱਦਾਂ ਕਿ ਹੁਣ ਮਾਹੌਲ ਹੀ ਪੂਰੀ ਤਰ੍ਹਾਂ ਚੇਂਜ ਹੋ ਗਿਆ ਇੰਡਸਟਰੀ ਨੇ ਇੰਨੀ ਕੁ ਆਪਣਾ ਪਰ ਦੁਨੀਆਂ 'ਚ ਮੋਬਾਇਲ ਦੇ ਵਿੱਚ ਗੇਮਾਂ ਦੇ ਵਿੱਚ ਬੱਚਿਆਂ ਨੂੰ ਪਾ ਕੇ ਪ੍ਰਚਾਰ ਕਰ ਲਿਆ ਕਿ ਬੱਚਿਆਂ ਨੂੰ ਹੁਣ ਪੁਰਾਣੀਆਂ ਖੇਡਾਂ ਅਤੇ ਗੇਮਾਂ ਬਾਰੇ ਪਤਾ ਹੀ ਨਹੀਂ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿਸ ਤਰ੍ਹਾਂ ਗੇਮਾਂ ਖੇਡੀਆਂ ਜਾਂਦੀਆਂ ਸੀ ਬੱਚੇ ਇਕੱਠੇ ਹੋ ਕੇ ਖੇਡਦੇ ਸੀ ਹੁਣ ਬੱਚਾ ਸਿੰਗਲ ਆਪਣਾ ਫ਼ੋਨ ਲੈਂਦਾ ਹੈ ਆਪਣੇ ਰੂਮ ਦੇ ਵਿੱਚ ਬੈਠਦਾ ਅਤੇ ਉਹ ਆਪਣੀ ਗੇਮ ਹੈ ਜਿਵੇਂ ਕਿ ਲੂਡੋ ਹੋਈ ਕਈ ਹੋਰ ਹੁੰਦੀਆਂ ਨੇ ਚੈਰਸ ਹੋ ਗਈ ਇੱਦਾਂ ਦੀਆਂ ਗੇਮਾਂ ਉਹ ਬੱਚੇ ਇੱਕ ਸਿੰਗਲ ਬੈਠ ਕੇ ਹੀ ਖੇਡਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਮੁਹੱਲੇ ਦੇ ਬੱਚੇ ਖੇਡਦੇ ਸੀਗੇ ਅਤੇ ਉਸ ਸ ਸਮੇਂ ਇੱਕ ਪਿਆਰ ਵੀ ਬਣਿਆ ਹੋਇਆ ਸੀਗਾ ਅਤੇ ਹੁਣ ਤਾਂ ਉਹ ਪਿਆਰ ਹੀ ਨਹੀਂ ਰਹਿ ਗਿਆ ਕਿਉਂਕਿ ਕੋਈ ਇਕੱਠਾ ਹੀ ਨਹੀਂ ਹੁੰਦਾ ਆਪਣਾ ਆਪਣਾ ਹਰ ਕੋਈ ਆਪਣੇ ਫ਼ੋਨ 'ਤੇ ਗੇਮ ਖੇਡ ਰਿਹਾ ਹੈ ਮੈਂ ਚਾਹੁੰਦੀ ਹਾਂ ਕਿ ਉਹ ਸਮਾਂ ਵਾਪਸ ਦੁਬਾਰਾ ਆ ਜਾਵੇ ਕਿ ਅਸੀਂ ਇਕੱਠੇ ਹੋ ਕੇ ਫਿਰ ਤੋਂ ਰੌਣਕਾਂ ਲਾਈਏ ਫਿਰ ਤੋਂ ਗੇਮਾਂ ਨੂੰ ਖੇਡੀਏ ਤਾਂ ਕਿ ਜਿਹੜਾ ਸਾਡਾ ਇਹ ਸਮਾਂ ਹੈ ਹੁਣ ਉਹ ਫਿਰ ਪਿੱਛੇ ਚਲਾ ਜਾਵੇ ਬਦਲ ਜਾਵੇ